ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਤੁਸੀਂ ਰੁਪਿੰਦਰ ਮੈਮ ਬੋਲਦੇ ਪਏ ਹਾਂਜੀ ਮੈਮ ਮੈਨੂੰ ਨਾ ਤੁਹਾਡਾ ਨੰਬਰ ਦਿੱਤਾ ਸੀ ਕਿਸੇ ਨੇ ਅਤੇ ਮੈਂ ਸ਼੍ਰੀ ਮੈਂ ਤੁਹਾਨੂੰ ਪੁੱਛਣਾ ਸ਼੍ਰੀ ਗੁਰੂ ਤੇਗ ਬਹਾਦਰ ਕੋਲੇਜ ਤੋਂ ਬੋਲਣ ਦੇ ਤੁਸੀਂ ਹਾਂਜੀ ਮੈਮ ਮੈਂ ਆਪਣੀ ਸਿਸਟਰ ਦੀ ਐਡਮਿਸ਼ਨ ਕਰਾਉਣੀ ਬੀ ਐੱਡ ਵਿੱਚ ਫਿਰ ਮੈਂ ਤੁਹਾਨੂੰ ਪੁੱਛਣਾ ਸੀ ਵੀ ਕਦੋਂ ਐਡਮਿਸ਼ਨਾਂ ਓਪਨ ਹੋਣੀਆਂ

ਹਾਂਜੀ ਹਾਂਜੀ ਮੈਮ

ਹਾਂਜੀ ਹਾਂਜੀ ਮੈਮ ਹਾਂਜੀ ਥੈਂਕ ਯੂ ਮੈਮ